ਮੇਰੇ ਅਨੁਸਾਰ ਇੱਕ ਵਧੀਆ ਡਾਂਸਰ ਦੇਖੋ ਡਾਂਸਰ ਤਾਂ ਵਧੀਆ ਹੈਗਾ ਹੀ ਆ ਉਸ ਤੋਂ ਇਲਾਵਾ ਕੀ ਹੈ ਉਹ ਇੱਕ ਵਧੀਆ ਇਨਸਾਨ ਹੈ ਅਤੇ ਆਪਣਾ ਜਿਹੜਾ ਸਭ ਤੋਂ ਵਧੀਆ ਉਹਦੀ ਖਾਸੀਅਤ ਕੀ ਹੁੰਦੀ ਹੈ ਕਿ ਜਿਹੜੀਆਂ ਉਹਦੀਆਂ ਫੀਲਿੰਗਜ਼ ਹੁੰਦੀਆਂ ਏ ਉਹ ਆਪਣੇ ਕੀ ਹੈ ਫੇਸ 'ਤੇ ਲੈ ਕੇ ਆਉਂਦਾ ਏ ਠੀਕ ਹੈ ਆਪਣੇ ਸਰੀਰ 'ਤੇ ਉਹਨਾਂ ਨੂੰ ਹੰਡਾਉਂਦਾ ਏ ਅਤੇ ਸਾਹਮਣੇ ਵਾਲੇ ਕੀ ਹੈ ਕਿ ਆਪਾਂ ਪਹਿਲੇ ਦੇਖਦੇ ਹੋਉਗੇ ਜ਼ਮਾਨੇ 'ਚ ਜਿਹੜੇ ਫਿਲਮਾਂ ਵੀ ਹੁੰਦੀਆਂ ਸੀਗੀਆਂ ਕਿ ਉਹਨਾਂ ਵਿੱਚ ਬੋਲਣ ਦਾ ਨਹੀਂ ਸੀਗਾ ਕਿ ਮਿਊਜ਼ਿਕ ਨਹੀਂ ਹੁੰਦਾ ਸੀਗਾ ਅਤੇ ਉਹ ਕੀ ਹੈ ਕਿ ਜਿਹੜੇ ਉਹਨਾਂ ਦੇ ਫੇਸ ਐਕਸਪ੍ਰੈਸ਼ਨ ਹੁੰਦੇ ਸੀਗੇ ਉਹ ਤੋਂ ਹੀ ਸਾਹਮਣੇ ਵਾਲਾ ਜਿਹੜੀ ਉਹਦੀਆਂ ਮੁਦਰਾਵਾਂ ਸੀਗੀਆਂ ਜੱਜ ਕਰਦਾ ਸੀਗਾ ਕਿ ਉਹ ਹੁਣ ਗੁੱਸੇ ਵਿੱਚ ਆ ਹੁਣ ਉਹ ਪਿਆਰ ਦੀ ਭਾਵਨਾ ਏ ਜਾਂ ਖੁਸ਼ੀ ਦੀ ਭਾਵਨਾ ਏ ਠੀਕ ਹੈ ਅਤੇ ਇੱਕ ਇਹ ਸਾਰਾ ਕੁਛ ਇੱਕ ਡਾਂਸਰ ਵਿੱਚ ਹੀ ਹੋ ਸਕਦਾ ਏ ਕਿ ਉਹ ਜਿਹੜੀਆਂ ਆਪਣੀਆਂ ਫੀਲਿੰਗਜ਼ ਨੂੰ ਆ ਕਿਵੇਂ ਉਹ ਬਾਹਰ ਲੈ ਕੇ ਆਉਂਦਾ ਏ ਅਤੇ ਲੋਕਾਂ ਦੇ ਸਾਹਮਣੇ ਉਹਨੂੰ ਉਜਾਗਰ ਕਰਦਾ ਏ